ਮੇਰੀਆਂ ਪਸੰਦੀਦਾ ਸ਼ੈਲੀਆਂ ਵਿੱਚ ਬਹੁਤ ਸਾਰੀਆਂ ਸ਼ੈਲੀਆਂ ਹਨ ਕੁਝ ਪਿਆਰ ਭਰੀਆਂ ਵੀ ਹਨ ਰੋਮਾਂਚਕ ਹਨ ਹੱਸਣ ਵਾਲੀਆਂ ਹਨ ਅਤੇ ਰੋਣ ਵਾਲੀਆਂ ਹਨ ਜਿਵੇਂ ਕਿ ਰੋਣ ਵਾਲੀਆਂ ਕਹਾਣੀਆਂ ਬਾਰੇ ਵਿੱਚੋਂ ਮੈਂ ਕੁਝ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਬਾਰੇ ਖੁੱਲ੍ਹ ਕੇ ਬਿਆਨ ਕਰਨਾ ਚਾਹੁੰਦੀ ਜਿਸ ਤੋਂ ਸਾਨੂੰ ਨਾਰੀ ਸ਼ਕਤੀ ਬਾਰੇ ਪਤਾ ਚੱਲਦਾ ਹੈ ਜਿਵੇਂ ਕਿ ਇੱਕ ਕਹਾਣੀ ਸੀ ਜੋ ਕਿ ਮੈਂ ਪੜ੍ਹੀ ਹੋਈ ਸੀ ਭੋਲੀ ਕਹਾਣੀ ਭੋਲੀ ਜੋ ਕਿ ਉਸਦੀਆਂ ਤਿੰਨ ਭੈਣਾਂ ਸਨ ਰਾਧਾ ਮੰਗਲਾ ਚੰਪਾ ਤਿੰਨ ਭੈਣਾਂ ਸਨ ਉਹ ਭੋਲੀ ਦੀਆਂ ਤਿੰਨੋਂ ਭੈਣਾਂ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਸਨ ਖੂਬਸੂਰਤ ਸਨ ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਸਨ ਭੋਲੀ ਦੇ ਦੋ ਭਰਾ ਵੀ ਸਨ ਜੋ ਕਿ ਕੋਲਜ ਪੜ੍ਹਨ ਲਈ ਜਾਂਦੇ ਸਨ ਭੋਲੀ ਨੂੰ ਕੋਈ ਵੀ ਪੜ੍ਹਨ ਲਈ ਨਹੀਂ ਸੀ ਭੇਜਦਾ ਕਿਉਂਕਿ ਉਸ ਜ਼ਮਾਨੇ ਕੁੜੀਆਂ ਨੂੰ ਪੜ੍ਹਨ ਦੀ ਆਗਿਆ ਨਹੀਂ ਸੀ ਉਹ ਬਾਹਰ ਨਹੀਂ ਭੇਜਣਾ ਚਾਹੁੰਦੇ ਸਨ ਅਤੇ ਨੇੜੇ ਛੇੜੇ ਕੋਈ ਸਕੂਲ ਵੀ ਨਹੀਂ ਸੀ ਭੋਲੀ ਦੀ ਜਦੋਂ ਉਹ ਦੋ ਮੰਥ ਦੀ ਦੋ ਮਹੀਨਿਆਂ ਦੀ ਹੋਈ ਸੀ ਤਾਂ ਉਹ ਮੰਜੇ ਤੋਂ ਡਿੱਗ ਗਈ ਸੀ ਜਿਸ ਕਾਰਨ ਉਹਦੇ ਮੈਂਟਲੀ ਪ੍ਰੋਬਲਮ ਹੋ ਗਈ ਸੀ ਉਹ ਦਿਮਾਗੀ ਤੌਰ 'ਤੇ ਉਹਨੂੰ ਪ੍ਰੋਬਲਮ ਹੋ ਗਈ ਸੀ ਜਦੋਂ ਕਿ ਪੰਜ ਸਾਲ ਦੀ ਹੋਈ ਸੀ ਉਦੋਂ ਉਹਦੇ ਚਿਕਨਪੋਕਸ ਹੋ ਗਿਆ ਸੀ ਆਈਜ਼ ਨੂੰ ਛ ਅੱਖਾਂ ਨੂੰ ਛੱਡ ਕੇ ਬਾਕੀ ਸਾਰਾ ਜਿਹੜਾ ਆ ਉਹਦਾ ਚਿਹਰਾ ਉਹ ਕਾਲੇ ਧੱਬਿਆਂ ਨਾਲ ਖਰਾਬ ਹੋ ਗਿਆ ਸੀ ਜਦੋਂ ਉਹ ਦਸ ਸਾਲ ਦੀ ਹੋਈ ਉਹ ਰੁਕ ਰੁਕ ਕੇ ਬੋਲਣ ਲੱਗੀ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਅੜਕ ਕੇ ਬੋਲਣ ਲੱਗਦੀ ਸੀ ਉਸਨੂੰ ਕੋਈ ਵੀ ਪਸੰਦ ਨਹੀਂ ਸੀ ਕਰਦਾ ਘਰ ਵਾਲੇ ਵੀ ਸੋਚ ਸੋਚ ਕੇ ਪਰੇਸ਼ਾਨ ਹੁੰਦੇ ਸਨ ਕਿ ਇਸ ਨਾਲ ਕੌਣ ਵਿਆਹ ਕਰਵਾਏਗਾ ਕੌਣ ਇਸ ਨੂੰ ਲੈ ਕੇ ਜਾਵੇਗਾ ਇਸ ਕਾਰਨ ਉਹ ਭੋਲੀ ਨੂੰ ਸਾਰੇ ਚੰਗਾ ਨਹੀਂ ਸੀ ਸਮਝਦੇ ਸਨ ਪਰ ਇੱਕ ਦਿਨ ਸਰਪੰਚ ਉਹਨਾਂ ਦੇ ਘਰ ਆਇਆ ਉਹਨਾਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਆਪਣੀ ਕਿਸੇ ਇੱਕ ਕੁੜੀ ਨੂੰ ਪਾਓ ਕਿਉਂਕਿ ਉਹ ਪਿੰਡ ਦਾ ਸਰਪੰਚ ਹੁੰਦਾ ਭੋਲੀ ਦਾ ਜੋ ਕਿ ਡੈਡੀ ਪਿਤਾ ਸੀ ਉਹ ਸਰਪੰਚ ਹੁੰਦਾ ਸੀ ਪਿੰਡ ਦਾ ਇਸ ਕਾਰਨ ਸਾਰੇ ਨਗਰ ਵਾਸੀਆਂ ਨੂੰ ਆਓ ਸਰਪੰਚ ਖੁਦ ਕਹਿੰਦਾ ਸੀ ਕਿ ਆਪਣੀਆਂ ਕੁੜੀਆਂ ਨੂੰ ਸਕੂਲ ਵਿੱਚ ਪਾਓ ਪਰ ਉਸਨੇ ਸਰਪੰਚ ਨੇ ਖੁਦ ਹੀ ਆਪਣੀ ਕੁੜੀ ਨੂੰ ਕੋ ਜਿਹੜਾ ਕਿ ਸਕੂਲ ਨਹੀਂ ਪਾਇਆ ਇਸ ਲਈ ਉਸਨੇ ਸੋਚਿਆ ਸਰਪੰਚ ਨੇ ਸੋਚਿਆ ਕਿ ਮੈਂ ਆਪਣੀ ਕੁੜੀ ਭੋਲੀ ਨੂੰ ਕੋ ਸਕੂਲ ਵਿੱਚ ਪਾ ਦੇਵਾਂ ਉਸਨੇ ਭੋਲੀ ਨੂੰ ਸਕੂਲ ਵਿੱਚ ਪਾ ਦਿੱਤਾ ਸਾਰੇ ਸਕੂਲ ਵਿੱਚ ਉਸਦਾ ਮਜ਼ਾਕ ਸਮਝਦੇ ਸਨ ਕਿਉਂਕਿ ਉਹ ਰੁਕ ਰੁਕ ਕੇ ਬੋਲਦੀ ਸੀ ਉਹਦਾ ਸਾਰੇ ਮਜ਼ਾਕ ਉਡਾਉਂਦੇ ਸਨ ਭੋਲੀ ਨੂੰ ਇੱਕ ਦਿਨ ਪਰ ਭੋਲੀ ਦਾ ਉਸਦੇ ਅਧਿਆਪਕ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਉਹ ਰੁਕ ਰੁਕ ਕੇ ਬੋਲਦੀ ਸੀ ਪਰ ਉਹ ਪੜ੍ਹਨ ਵਿੱਚ ਵੀ ਥੋੜ੍ਹਾ ਬਹੁਤਾ ਠੀਕ ਹੋ ਗਈ ਅਤੇ ਜਦੋਂ ਇੱਕ ਦਿਨ ਉਸਨੂੰ ਰਿਸ਼ਤਾ ਆਇਆ ਬਿਸ਼ੰਬਰ ਦਾ ਬਿਸ਼ੰਬਰ ਨੇ ਉਸ ਤੋਂ ਕੁਝ ਪੈਸਿਆਂ ਦੀ ਮੰਗ ਕੀਤੀ ਜਿਸ ਕਾਰਨ ਜਦੋਂ ਭੋਲੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਇਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਮੈਂ ਕਿਸੇ ਵੀ ਰਿਸ਼ਵਤਖੋਰੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਇਸ ਬਾਰੇ ਮੈਨੂੰ ਬਲਕਿ ਇੱਕ ਮਤਲਬ ਨਾਰੀ ਸ਼ਕਤੀ ਬਾਰੇ ਪਤਾ ਚੱਲਦਾ ਹੈ ਕਿ ਕਿੰਝ ਮਤਲਬ ਉਹਦਾ ਚਿਹਰਾ ਖਰਾਬ ਸੀ ਉਸ ਨੂੰ ਰੁਕ ਰੁਕ ਕੇ ਪਰ ਉਸ ਵੀ 'ਤੇ ਸਕੂਲ ਜਾਣ ਤੋਂ ਬਾਅਦ ਉਹਦੇ ਵਿੱਚ ਆਤਮ ਨਿਰਭਰ ਬਣ ਗਈ ਭੋਲੀ ਅਗਰ ਘਰ ਰਹਿੰਦੀ ਤਾਂ ਉਹਦੇ ਵਿੱਚ ਇੰਨਾ ਜ਼ਿਆਦਾ ਆਤਮ ਨਿਰਭਰ ਨਹੀਂ ਸੀ ਹੋਣਾ ਕਿਉਂਕਿ ਉਹ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਸੀ ਪਰ ਜਦੋਂ ਉਹ ਸਕੂਲ ਵਿੱਚ ਪਈ ਤਾਂ ਉਹ ਇੱਕ ਆਤਮ ਨਿਰਭਰ ਉਸ ਵਿੱਚ ਪੈਦਾ ਹੋ ਗਿਆ ਅਤੇ ਉਸ ਵਿੱਚ ਨਾਰੀ ਸ਼ਕਤੀ ਬਾਰੇ ਪਤਾ ਚੱਲਦਾ ਹੈ